ਪੰਜਾਬ ਜਿਸ ਦਾ ਮਤਲਬ ਹੀ ਪੰਜ ਦਰਿਆ ਹੈ ਜਿੱਥੇ ਪੰਜ ਨਦੀਆਂ ਪੰਜਾਬ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੀਆਂ ਹਨ ਭਾਵੇਂ ਦੇਸ਼ ਦੀ ਵੰਡ ਦੇ ਵਿੱਚ ਕੁਛ ਨਦੀਆਂ ਦਾ ਪਾਣੀ ਪਾਕਿਸਤਾਨ ਵੱਲ ਚਲਾ ਗਿਆ ਹੈ ਪਰ ਫਿਰ ਵੀ ਪੰਜਾਬ ਦੀ ਧਰਤੀ ਇੱਕ ਹਰਿਆਲ ਹਰਿਆਵਲ ਧਰਤੀ ਗਿਣੀ ਗਈ ਹੈ ਇਹ ਕਿਸਾਨਾਂ ਦੀ ਧਰਤੀ ਹੈ ਅਤੇ ਨਦੀਆਂ ਦਾ ਪਾਣੀ ਇੱਥੋਂ ਦੀਆਂ ਨਦੀਆਂ ਦਾ ਪਾਣੀ ਜ਼ਿਆਦਾਤਰ ਸਿੰਚਾਈ ਲਈ ਯੂਜ ਹੁੰਦਾ ਹੈ ਅਤੇ ਇੱਥੋਂ ਦੇ ਜਿਹੜੇ ਪਹਾੜ ਜਿੱਦਾਂ ਜਦੋਂ ਆਪਾਂ ਆਨੰਦਪੁਰ ਸਾਹਿਬ ਵੱਲ ਜਾਈਏ ਅਤੇ ਜਿਹੜੀ ਕਿ ਪੰਜਾਬ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਦ ਲਗਾ ਦਿੰਦੀ ਹੈ ਅਤੇ ਹੋਰ ਨਦੀਆਂ ਦਾ ਕਈ ਪਾਣੀ ਪੰਜਾਬ ਤੋਂ ਇਲਾਵਾ ਵੀ ਪੰਜਾਬ ਦੀ ਨਦੀਆਂ ਦਾ ਪਾਣੀ ਪੰਜਾਬ ਤੋਂ ਇਲਾਵਾ ਵੀ ਪੰਜਾਬ ਪਾਕਿਸਤਾਨ ਅਤੇ ਹਰਿਆਣੇ ਦੇ ਨਾਲ ਪੰਜਾਬ ਸਾਂਝਾ ਕਰਦਾ ਹੈ ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਨ ਕਿ ਪੰਜਾਬ ਦੀ ਭੌਤਿਕ ਪਰਭੌਤਿਕ ਜਿਵੇਂ ਕਿ ਨਦੀਆਂ ਉਹ ਇਕੱਲਾ ਪੰਜਾਬ ਦਾ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਨਹੀਂ ਬਲਕਿ ਪੰਜਾਬ ਤੋਂ ਹਰਿਆਣਾ ਪਾਕਿਸਤਾਨ ਦ ਦੇਸ਼ ਆਦਿ ਦਾ ਵੀ ਉਹਨਾਂ ਦੇ ਲੋਕਾਂ ਦਾ ਵੀ ਜੀਵਨ ਨਿਰਵਾਹ ਦੇ ਵਿੱਚ ਹ ਬਹੁਤ ਵੱਡਾ ਹੱਥ ਨਿਭਾਉਂਦੀਆਂ ਹਨ